ਬਿਲਕੁਲ ਜੀ ਅਸੀਂ ਧਾਰਮਿਕ ਸਮਾਗਮ ਜਿਹੜਾ ਹੈ ਇਕੱਠੇ ਹੋ ਕੇ ਮਨਾਉਂਦੇ ਹਾਂ ਜਿਵੇਂ ਕਿ ਬਾਬਾ ਦੀਪ ਸਿੰਘ ਜੀ ਦਾ ਗੁਰਪੁਰਬ ਜਨਮ ਦਿਹਾੜਾ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹੜਾ ਮਨਾਉਣ ਦੇ ਲਈ ਅਸੀਂ ਲੱਖਾਂ ਦੀ ਗਿਣਤੀ ਦੇ ਵਿੱਚ ਸਾਡਾ ਭਾਈਚਾਰਾ ਜਿਹੜਾ ਹੈ ਗੁਰਦੁਆਰੇ ਸ਼ਹੀਦ ਚੱਟ ਵਿੰਡ ਚੌਂਕ ਇਕੱਤਰ ਹੁੰਦੇ ਹਾਂ ਗੁਰਪੁਰਬ ਜਨਮ ਦਿਹਾੜਾ ਮਨਾਉਣ ਦੇ ਲਈ ਅਸੀਂ ਅਖੰਡ ਪਾਠ ਦਾ ਭੋਗ ਪਾਉਂਦੇ ਹਾਂ ਉਸ ਤੋਂ ਬਾਅਦ ਵਾਰਾਂ ਗਾਈਆਂ ਜਾਂਦੀਆਂ ਹਨ ਕਥਾਵਾਂ ਗਈਆਂ ਦੱਸੀਆਂ ਜਾਂਦੀਆਂ ਹਨ ਬਾਬਾ ਜੀ ਦਾ ਜਨਮ ਜੀਵਨ ਦੇ ਬਾਰੇ ਦੱਸਿਆ ਜਾਂਦਾ ਹੈ ਉਹਨਾਂ ਦੇ ਅੰਤਿਮ ਸ਼ਣ ਬਾਰੇ ਦੱਸਿਆ ਜਾਂਦਾ ਹੈ ਉਸ ਤੋਂ ਇਲਾਵਾ ਲੰਗਰ ਲਗਾਏ ਜਾਂਦੇ ਹਨ ਉਸ ਤੋਂ ਇਲਾਵਾ ਨਗਰ ਕੀਰਤਨ ਨਿਕਾਲੇ ਜਾਂਦੇ ਹਨ ਭਾਈਚਾਰਾ ਇਕੱਠਾ ਹੁੰਦਾ ਹੈ ਆਪਣਾ ਸੀਸ ਨਿਵਾਉਂਦਾ ਹੈ ਗੁਰੂ ਜੀ ਦੀਆਂ ਜਨਮ ਦਿਹਾੜੇ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਸਭ ਦਾ ਆਪਣਾ ਆਪਣਾ ਤਰੀਕਾ ਹੈ ਗੁਰੂ ਜੀ ਦਾ ਜਨਮ ਦਿਹਾੜਾ ਮਨਾਉਣ ਦਾ ਕਥਾਵਾਚਕ ਵੱਧ ਤੋਂ ਵੱਧ ਚੜ ਕੇ ਕਥਾ ਕਰਦੇ ਹਨ ਬਾਬਾ ਜੀ ਦੇ ਜੀਵਨ ਜਿਹੜਾ ਵਿਸ਼ੇਸ਼ ਜੀਵਨ ਹੈ ਉਸਦੇ ਉੱਪਰ ਚਾਨਣਾ ਪਾਉਂਦੇ ਹਨ ਲੋਕਾਂ ਨੂੰ ਇਸ ਦੇ ਨਾਲ ਜੋੜਿਆ ਜਾਂਦਾ ਹੈ ਜਿਹੜੇ ਲੋਕ ਆਪਣੇ ਧਰਮ ਤੋਂ ਬੇਮੁੱਖ ਹੋ ਚੁੱਕੇ ਹਨ ਉਹਨਾਂ ਨੂੰ ਇਸ ਇਹਨਾਂ ਸਮਾਗਮਾਂ ਦੇ ਰਾਹੀਂ ਜੋੜਿਆ ਜਾਂਦਾ ਹੈ ਅੱਜ ਕੱਲ੍ਹ ਚੋਪਿਹਰਾ ਸਾਹਿਬ ਬਹੁਤ ਚੱਲ ਰਿਹਾ ਹੈ ਲੋਕ ਚੋਪਿਹਰਾ ਸਾਹਿਬ ਦੇ ਕਾਰਨ ਉੱਥੇ ਜੁੜ ਰਹੇ ਹਨ ਇਕੱਤਰ ਹੁੰਦੇ ਹਨ ਲੱਖਾਂ ਦੀ ਗਿਣਤੀ ਵਿੱਚ ਸੰਗਤ ਜਿਹੜੀ ਹੈ ਇਕੱਠੀ ਹੁੰਦੀ ਹੈ ਅਤੇ ਇਸ ਪ੍ਰਕਾਰ ਨਾਲ ਸਿੱਖੀ ਦਾ ਪ੍ਰਚਾਰ ਵੀ ਵੱਧ ਰਿਹਾ ਹੈ ਧੰਨਵਾਦ